ਸਾਡੇ ਖੇਤਰ ਵਿੱਚ ਕੁੜਤੇ ਪਜਾਮੇ ਦੀ ਸਿਲਾਈ ਬਹੁਤ ਮਸ਼ਹੂਰ ਹੈ ਇਹ ਕੁੜਤੇ ਪਜਾਮੇ ਵੱਖ ਵੱਖ ਤਰੀਕਿਆਂ ਨਾਲ ਬਣਾਏ ਜਾਂਦੇ ਹਨ ਅਤੇ ਵੱਖ ਵੱਖ ਕੱਪੜਿਆਂ ਦੇ ਬਣਾਏ ਜਾਂਦੇ ਹਨ ਮੈਂ ਵੀ ਕੁਝ ਸਮੇਂ ਪਹਿਲਾਂ ਇੱਕ ਪਠਾਣੀ ਸੂਟ ਬਣਵਾਇਆ ਸੀ ਜਿਹੜਾ ਕਿ ਕਾਲ਼ੇ ਰੰਗ ਦਾ ਸੀ ਜੂਟ ਦੇ ਕੱਪੜੇ ਦਾ ਬਣਾਇਆ ਸੀ